ਉੱਤਰੀ ਭਾਰਤ ਅਤੇ ਦੱਖਣੀ ਭਾਰਤ ਜਿਹੜਾ ਮੁੱਖ ਸੱਭਿਆਚਾਰਕ ਅੰਤਰ ਏ ਆ ਉਹਦੇ ਵਿੱਚ ਜਿੱਦਾਂ ਭਾਸ਼ਾ ਦੇ ਆਧਾਰ 'ਤੇ ਗੱਲ ਕਰੀਏ ਅਤੇ ਪੰਜਾਬ ਦੇ ਵਿੱਚ ਉੱਤਰੀ ਭਾਰਤ 'ਚ ਪੰਜਾਬੀ ਹਰਿਆਣੇ ਵਿੱਚ ਹਰਿਆਣਵੀ ਜਿਹੜੇ ਰਾਜਸਥਾਨ ਦੇ ਵਿੱਚ ਉਹ ਮਾੜਵਾੜੀ ਬੋਲੀ ਜਾਂਦੀ ਏ ਆਮ ਭਾਸ਼ਾ ਏ ਮੇਨ ਅਤੇ ਜਿਹੜੀ ਹਿੰਦੀ ਆ ਉਹ ਸਾਰਿਆਂ ਦੀ ਰਾਸ਼ਟਰੀ ਭਾਸ਼ਾ ਵਾ ਜਿਹੜਾ ਸਾਊਥ ਭਾਰਤ ਦੇ ਵਿੱਚ ਦੱਖਣੀ ਭਾਰਤ 'ਚ ਉਹ ਤਾਮਿਲ ਬੋਲੀ ਜਾਂਦੀ ਆ ਤੇਲਗੂ ਬੋਲਦੇ ਆ ਕਈਆਂ ਰਾਜਾਂ ਵਿੱਚ ਕੰਨੜ ਬੋਲੀ ਜਾਂਦੀ ਆ ਅਤੇ ਹਿੰਦੀ ਭਾਸ਼ਾ ਨੂੰ ਉਹ ਬਹੁਤ ਘੱਟ ਸਮਝਦੇ ਆ ਜਿਹੜਾ ਜੇ ਇਹਦੇ ਬਾਰੇ ਕਰੀਏ ਖਾਣੇ ਪੀਣੇ ਦੀ ਗੱਲ ਤਾਂ ਪੰਜਾਬ ਦੇ ਵਿੱਚ ਦਾਲ ਰੋਟੀ ਹਰੀਆਂ ਸਬਜ਼ੀਆਂ ਆਦਿ ਜਿਹੜੇ ਉਹ ਮੁੱਖ ਭੋਜਨ ਖਾਂਦੇ ਲੋਕ ਜਿਹੜੇ ਆ ਸੋਥ ਦੇ ਵਿੱਚ ਉਹ ਜ਼ਿਆਦਾਤਰ ਲੋਕ ਇਡਲੀ ਡੋਸਾ ਸਾਂਬਰ ਮੱਛੀ ਚੌਲ ਇਹਨਾਂ ਚੀ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਹੁਣ ਗੱਲ ਕੀਤੀ ਜਾਵੇ ਜੇ ਕੱਪੜੇ ਬਾਰੇ ਤਾਂ ਉਹਦੇ 'ਚ ਪੰਜਾਬ ਦਾ ਅਤੇ ਹਰਿਆਣੇ ਦਾ ਜਿਹੜਾ ਪਹਿਰਾਵਾ ਵਾ ਇੰਨਾਂ ਉੱਤਰੀ ਭਾਰਤ ਦਾ ਇਹ ਜ਼ਿਆਦਾਤਰ ਹੈਗਾ ਵਾ ਕੁੜਤਾ ਕੁੜਤਾ ਪਜਾਮਾ ਪੈਂਟ ਸ਼ਰਟ ਆਦਿ ਜਿਹੜਾ ਦੱਖਣੀ ਭਾਰਤ ਦੇ ਵਿੱਚ ਆ ਉਹ ਜ਼ਿਆਦਾਤਰ ਧੋਤੀ ਲੂੰਗੀ ਆਦਿ ਪਾਉਂਦੇ ਆ ਅਤੇ ਜੇ ਮੌਸਮ ਵੱਲੋਂ ਵੇਖਿਆ ਜਾਵੇ ਤਾਂ ਜਿਹੜਾ ਉੱਤਰੀ ਭਾਰਤ ਵਿੱਚ ਗਰਮੀਆਂ ਦੇ ਵਿੱਚ ਜਿਹੜੇ ਆ ਉਹ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਬਰਸਾਤ ਉਹਦੇ 'ਚ ਬਰਸਾਤ ਵੀ ਕਾਫੀ ਹੁੰਦੀ ਆ ਅਤੇ ਸਰਦੀਆਂ 'ਚ ਠੰਡ ਵੀ ਜ਼ਿਆਦਾ ਹੁੰਦੀ ਆ ਜਦੋਂ ਕਿ ਜਿਹੜਾ ਦੱਖਣੀ ਭਾਰਤ ਦਾ ਮੌਸਮ ਆ ਉਹ ਲਗਭਗ ਇੱਕੋ ਜਿਹਾ ਰਹਿੰਦਾ ਵਾ ਕਿਉਂਕਿ ਉੱਧਰ ਸਮੁੰਦਰ ਦਾ ਇਲਾਕਾ ਹੋਣ ਕਰਕੇ ਨਾ ਟੈਂਪਰੇਚਰ ਲਾਗੇ ਲਾਗੇ ਰਹਿੰਦਾ ਏ